ਮੇਰੇ ਹਿਸਾਬ ਨਾਲ ਪੰਛੀਆਂ ਨੂੰ ਦੇਖਣ ਲਈ ਕਿਸੇ ਵੀ ਸਾਧਨ ਦੀ ਜਰੂਰਤ ਨਹੀਂ ਹੈ ਕਿਉਂਕਿ ਜਿਹੜੀ ਅੱਖਾਂ ਨੇ ਇਹ ਵੱਡੀ ਦੂਰਬੀਨ ਇਹ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ ਇਹਨਾਂ ਨਾਲ ਹੀ ਅਸੀਂ ਸਭ ਕੁਝ ਦੇਖਦੇ ਹਾਂ ਤੇ ਜੇ ਸਭ ਕੁਝ ਅਸੀਂ ਇਹਨਾਂ ਨੂੰ ਦੇਖ ਸਕਦੇ ਹਾਂ ਤੇ ਇਹ ਬੜਾ ਸੋਹਣਾ ਦਿਖ ਜਾਂਦੀਆਂ ਨੇ ਤੇ ਪਰਮਾਤਮਾ ਇਹ ਸਾਨੂੰ ਪੰਛੀਆਂ ਨੂੰ ਦੇਖਣ ਨੂੰ ਬੜੀ ਸਮਝ ਦਿੰਦਾ ਹੈ ਜਿਆਦਾ ਅੱਛੀ ਤਰ੍ਹਾਂ ਸਾਨੂੰ ਦੇਖਣ ਹੁੰਦਾ ਹੈ ਜਿਹੜਾ ਕਿ ਸਾਨੂੰ ਹਜੇ ਤੱਕ ਲੋੜ ਨਹੀਂ ਹੈ ਪਰਮਾਤਮਾ ਜਿਹੜਾ ਇਕ ਇਹ ਪੰਛੀਆਂ ਦੇ ਜਰੀਏ ਸਾਡੇ ਆਪਣੇ ਜਰੀਆ ਸਾਨੂੰ ਪਰਮਾਤਮਾ ਨੇ ਅੱਖਾਂ ਦਿੱਤੀਆਂ ਨੇ ਪੰਛੀਆਂ ਨੂੰ ਅਸੀਂ ਦੇਖਣ ਲਈ ਸਾਨੂੰ ਅਸੀਂ ਇਹਨਾਂ ਨੂੰ ਦੇਖ ਸਕਦੇ ਹਾਂ ਇਹ ਬੜੇ ਹੀ ਅੱਛੇ ਢੰਗ ਨਾਲ ਅਸੀਂ ਇਹਨਾਂ ਨੂੰ ਦੇਖਣ ਦੀ ਜਰੂਰਤ ਹੈ ਇਹਨਾਂ ਨੂੰ ਸਮਝਣ ਦੀ ਜਰੂਰਤ ਹੈ ਇਨਾ ਪੰਛੀਆਂ ਨੂੰ ਕਿ ਸਰ ਮੇਰੇ ਵਾਸਤੇ ਇਹਦਾ ਕੋਈ ਵੀ ਕੋਈ ਵੀ ਹੈਗਾ ਨਹੀਂ ਕੋਈ ਵੀ ਸਮਾਨ ਬਣਿਆ ਹੋਵੇ ਜਿਹੜਾ ਕਿ ਮੇਰੇ ਲਈ ਜਿਹੜਾ ਕਿ ਜਰੂਰੀ ਹੈ ਮੈਂ ਇਸਨੂੰ ਇਦਾਂ ਹੀ ਦੇਖਦੀ ਆਂ ਤੇ ਇਦਾਂ ਹੀ ਇਹਨਾਂ ਨਾਲ ਗੱਲਾਂ ਕਰਦੀ ਆ ਪੰਛੀਆਂ ਨਾਲ ਤੇ ਇਸ ਤਰ੍ਹਾਂ ਹੀ ਇਹਨਾਂ ਨੂੰ ਦੇਖ ਕੇ ਇਹਨਾਂ ਨਾਲ ਕਈ ਦੋ ਦੋ ਚਾਰ ਚਾਰ ਮਿੰਟ ਇਹਨਾਂ ਨਾਲ ਬਿਤਾ ਦਿੰਦੀ ਆ ਜਿਹੜਾ ਕਿ ਮੈਨੂੰ ਬੜਾ ਚੰਗਾ ਲੱਗਦਾ ਹੈ ਮੈਂ ਇਹਨਾਂ ਨਾਲ ਹੀ ਗੱਲਾਂ ਕਰਦੀ ਰਹਿੰਦੀ ਆ ਤੇ ਦੇਖ ਕੇ ਪਰਮਾਤਮਾ ਦੀ ਯਾਦ ਆਉਂਦੀ ਹੈ ਮੈਨੂੰ ਇਹਨਾ ਦੇਖ ਦੇਖ ਕੇ ਤੇ ਪਰਮਾਤਮਾ ਯਾਦ ਆਉਂਦਾ ਰਹਿੰਦਾ ਹੈ ਤੇ ਮੈਂ ਇਹਨਾਂ ਨਾਲ ਖੜੀ ਖੜੀ ਇਹਨਾਂ ਨਾਲ ਦੇਖਦੀ ਨਾਲੇ ਪਰਮਾਤਮਾ ਨੂੰ ਯਾਦ ਕਰਦੀ ਆ ਕਿ ਤੇਰੀ ਬਨਤ ਕਿੰਨੀ ਸੋਹਣੀ ਬਣਾਈ ਆ ਤੇ ਤੂੰ ਬਹੁਤ ਸੋਹਣਾ ਕਿੰਨਾ ਹੋਏਗਾ ਤੇ ਇਸਦੇ ਲਈ ਮੈਨੂੰ ਤਾਂ ਇਹ ਲੱਗਦਾ ਕੋਈ ਕਿਸੇ ਅੱਖਾਂ ਤੋਂ ਬਾਅਦ ਕੋਈ ਦੂਰਬੀਨ ਨਹੀਂ ਹੈ ਜਿਹੜੀ ਕਿ ਇਸਨੂੰ ਦੇਖਣ ਦੀ ਲੋੜ ਪਵੇ ਧੰਨਵਾਦ